ਵੈਸੇ ਮੈਂ ਸਪੈਸ਼ਲੀ ਕੋਈ ਕੋਚਿੰਗ ਨਹੀਂ ਲਈ ਪਰ ਜਦੋਂ ਮੈਂ ਸਕੂਲ ਟਾਈਮ ਸੀ ਉਦੋਂ ਮੈਂ ਹੋਮ ਸਾਇੰਸ ਸਬਜੈਕਟ ਨਾਲ਼ ਰੱਖਿਆ ਹੋਇਆ ਸੀ ਉਦੋਂ ਕੁਕਿੰ ਕੁਕਿੰਗ ਦੀਆਂ ਕੁਛ ਕੁ ਸਾਨੂੰ ਰੈਸਪੀਜ਼ ਸਿਖਾਈਆਂ ਗਈਆਂ ਸੀ ਜਿਵੇਂ ਇਡਲੀ ਡੋਸਾ ਸਾਂਬਰ ਪਾਸਤਾ ਇਹ ਮੈਂ ਬਹੁਤ ਵਧੀਆ ਸਿੱਖ ਗਈ ਸੀ ਅਤੇ ਮੈਂ ਆਪਣੇ ਫੈਮਲੀ ਨੂੰ ਅਕਸਰ ਹੁਣ ਵੀ ਬਣਾ ਕੇ ਖਵਾਉਂਦੀ ਰਹਿੰਦੀ ਹਾਂ ਅਤੇ ਮੇਰੇ ਫਰੈਂਡਸ ਜਦੋਂ ਘਰ ਆਉਂਦੇ ਆ ਤਾਂ ਸਪੈਸ਼ਲ ਓਕੇਜ਼ਨਸ 'ਤੇ ਮੈਂ ਹਮੇਸ਼ਾਂ ਇਹ ਰੈਸਪੀਸ ਬਣਾਉਂਦੀ ਹੀ ਬਣਾਉਂਦੀ ਹਾਂ ਅਤੇ ਸਾਰੇ ਬਹੁਤ ਜ਼ਿਆਦਾ ਤਾਰੀਫ਼ ਕਰਦੇ ਆ ਵੀ ਬਹੁਤ ਸਵਾਦ ਬਣਾਈਆਂ ਨੇ ਮੈਂ ਕਾਫ਼ੀ ਟਾਈਮ ਪਹਿਲਾਂ ਸਿੱਖ ਗਈ ਸੀ ਪਰ ਹੁਣ ਮੇਰਾ ਬਹੁਤ ਮਨ ਕਰਦਾ ਕਿ ਮੈਂ ਗੁਲਾਬ ਜਾਮਣ ਅਤੇ ਮਨਚੂਰੀਅਨ ਸਿੱਖਾਂ ਇਹ ਮੈਂ ਉਸ ਟਾਈਮ ਨਹੀਂ ਸਿੱਖ ਪਾਈ ਸੀਗੀ ਅਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਹੁਣ ਸਿੱਖਣ ਦੀ ਜੇ ਕਦੇ ਵੀ ਮੈਨੂੰ ਮੌਕਾ ਮਿਲਦਾ ਫਿਊਚਰ ਦੇ ਵਿੱਚ ਤਾਂ ਮੈਂ ਜ਼ਰੂਰ ਟਰਾਈ ਕਰੂੰਗੀ ਇਹ ਦੋਵੇਂ ਚੀਜ਼ਾਂ ਸਿੱਖਣ ਦੀ